ਭੰਗੜਾ ਐਰੋਬਿਕ ਮੁਕਾਬਲੇ ਪੰਜਾਬੀ ਸੱਭਿਆਚਾਰਕ ਅਤੇ ਵਿਰਸੇ ਨੂੰ ਸੰਭਾਲਣ ਅਤੇ ਮਨਾਉਣ ਦੋਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਰਿਵਾਇਤੀ ਭੰਗੜੇ ਦੀਆਂ ਲਹਿਰਾਂ ਨੂੰ ਇੱਕ ਆਧੁਨਿਕ ਐਰੋਬਿਕ ਫੌਰਮੈਟ ਵਿੱਚ ਜੋੜ ਕੇ ਇਹ ਮੁਕਾਬਲੇ ਇਸਦੀਆਂ ਸੱਭਿਆਚਾਰਕ ਜੜ੍ਹਾਂ ਦਾ ਸਨਮਾਨ ਕਰਦੇ ਹੋਏ ਨਾਚ ਦੇ ਰੂਪ ਨੂੰ ਢੁੱਕਵੇਂ ਅਤੇ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਣਯੋਗ ਰੱਖਣ ਵਿੱਚ ਮਦਦ ਕਰਦੇ ਹਨ ਊਰਜਾਵਾਨ ਅਤੇ ਸਮਕਾਲੀ ਰੁਟੀਨ ਇੱਕ ਸਮਕਾਲੀ ਮਹੌਲ ਵਿੱਚ ਰਿਵਾਇਤੀ ਕਦਮਾਂ ਨੂੰ ਪ੍ਰਦਰਸ਼ਿਤ ਕਰਦੇ ਹਨ ਪੰਜਾਬੀ ਸੱਭਿਆਚਾਰਕ ਅਭਿਆਸਾਂ ਵੱਲ ਧਿਆਨ ਖਿੱਚਦੇ ਹਨ ਅਤੇ ਮਾਨ ਅਤੇ ਨਿਰੰਤਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ ਇਹ ਸਮਾਗਮ ਅਕਸਰ ਵਿਭਿੰਨ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਸੱਭਿਆਚਾਰਕ ਵਟਾਂਦਰੇ ਅਤੇ ਸਿੱਖਿਆ ਦਾ ਮੌਕਾ ਪ੍ਰਦਾਨ ਕਰਦੇ ਹਨ ਪ੍ਰੰਪਰਾ ਨੂੰ ਆਧੁਨਿਕਤਾ ਨਾਲ ਮਿਲਾ ਕੇ ਭੰਗੜਾ ਐਰੋਬਿਕ ਮੁਕਾਬਲੇ ਨਾ ਸਿਰਫ਼ ਪੰਜਾਬੀ ਵਿਰਸੇ ਦਾ ਜਸ਼ਨ ਮਨਾਉਂਦੇ ਹਨ ਸਗੋਂ ਇਸ ਨੂੰ ਸਮਕਾਲੀ ਸੁਆਦਾਂ ਅਨੁਸਾਰ ਢਾਲ ਕੇ ਅਤੇ ਵਿਆਪਕ ਪਲੇਟਫਾਰਮਾਂ ਅਤੇ ਇਸ ਦੀ ਦਿੱਖ ਨੂੰ ਉਤਸ਼ਾਹਿਤ ਕਰ ਕੇ ਇਸਦੀ ਸੰਭਾਲ ਨੂੰ ਯਕੀਨੀ ਬਣਾਉਂਦੇ ਹਨ ਪ੍ਰੰਪਰਾ ਅਤੇ ਨਵੀਨਤਾ ਦਾ ਇਹ ਸੰਯੋਜਨ ਨਵੇਂ ਦਰਸ਼ਕਾਂ ਨੂੰ ਸ਼ਾਮਿਲ ਕਰਦੇ ਹੋਏ ਸੱਭਿਆਚਾਰਕ ਅਭਿਆਸਾਂ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਇੱਕ ਗਤੀਸ਼ੀਲ ਅਤੇ ਵਿਕਾਸਸ਼ੀਲ ਸੰਸਾਰ ਵਿੱਚ ਸੱਭਿਆਚਾਰਕ ਵਿਰਾਸਤ ਦੀ ਮਹੱਤਤਾ ਨੂੰ ਮਜ਼ਬੂਤ ਕਰਦਾ ਹੈ